ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਚਾਣ ਲਿਆ ਮੈਨੂੰ ਮਨਦੀਪ ਸਿੰਘ ਬੋਲ ਰਿਹਾ ਮੈਂ ਤੁਸੀਂ ਤਰਨਜੋਤ ਬੋਲ ਰਹੇ ਹੋ ਮੈਂ ਘੰਟਾ ਕੁ ਪਹਿਲਾਂ ਤੁਹਾਡੀ ਕੈਬ ਬੁੱਕ ਕਰੀ ਸੀ ਮੈਂ ਖੰਨੇ ਤੋਂ ਚੰਡੀਗੜ੍ਹ ਜਾਣਾ ਸੀ ਕਿਸੇ ਜ਼ਰੂਰੀ ਮੀਟਿੰਗ ਲਈ ਅਤੇ ਉਹ ਵੀ ਜਲਦੀ ਪਰ ਤੁਸੀਂ ਹਜੇ ਕਹਿ ਰਹੇ ਹੋ ਕਿ ਮੈਨੂੰ ਆਉਣ ਵਿੱਚ ਦੋ ਤੋਂ ਤਿੰਨ ਘੰਟੇ ਲੱਗਣਗੇ ਪਰ ਮੈਂ ਜਲਦੀ ਜਾਣਾ ਹੈ ਜਿਸ ਕਰਕੇ ਮੈਂ ਤੁਹਾਡੀ ਕੈਬ ਰੱਦ ਕਰ ਰਿਹਾ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਹੋਰ ਕੈਬ ਬੁੱਕ ਕਰ ਲਈ ਸੀ ਜੋ ਮੈਨੂੰ ਲੈ ਕੇ ਜਾ ਰਿਹਾ ਹੈ ਅਤੇ ਮੈਂ ਪਹੁੰਚਣ ਵਾਲਾ ਵੀ ਹਾਂ ਅਤੇ ਇਹ ਕੈਬ ਮੈਨੂੰ ਥੋੜ੍ਹੀ ਸਸਤੀ ਵੀ ਪੈ ਰਹੀ ਹੈ